ਹੈਲੋ ਭਾਅ ਜੀ ਸਤਿ ਸ਼੍ਰੀ ਅਕਾਲ ਤੁਸੀਂ ਸ਼ਗਨ ਢਾਬੇ ਤੋਂ ਬੋਲਦੇ ਭਾਅ ਜੀ ਮੈਂ ਤੁਹਾਨੂੰ ਔਡਰ ਔਡਰ ਕੀਤਾ ਸੀ ਜਿਹਦੇ ਵਿੱਚ ਮੈਂ ਜਿਹਦੇ ਵਿੱਚ ਦਾਲਾਂ ਜੀ ਸੁੱਕੀ ਸਬਜ਼ੀ ਛੋਲੇ ਭਟੂਰੇ ਅਤੇ ਕਾਫ਼ੀ ਵ ਫਾਸਟ ਫੂਡ ਸੀ ਕਾਫ਼ੀ ਕੁਛ ਸੀ ਜਾਣੀ ਕਿ ਤੁ ਤੁਸੀਂ ਅਤੇ ਡਰਿੰਕ ਜੀ ਕਾਫ਼ੀ ਕੁਛ ਮੈਂ ਕਿਹਾ ਸੀ ਜੀ ਤੁਸੀਂ ਹੋਰ ਸੁੱਕੀ ਸਬਜ਼ੀ ਵਿੱਚ ਜੀ ਜਿੱਦਾਂ ਮਤਲਬ ਭਿੰਡੀਆਂ ਜੀ ਦਾਲਾਂ ਵਗੈਰਾ ਦਾਲਾਂ ਰੋਟੀ ਰੋਟੀ ਜੀ ਅਤੇ ਬਹੁਤ ਕੁਛ ਸੀ ਇਹ ਦੇ ਵਿੱਚ ਸਰ ਸਰ ਜੀ ਕਾਫ਼ੀ ਦੇਰੀ ਹੋ ਗਈ ਤੁਸੀਂ ਦੱਸੋ ਵੀ ਮੈਂ ਕ ਮੈਂ ਫ਼ੋਨ ਕੀਤਾ ਸੀ ਤੁਸੀਂ ਕਿਹਾ ਵੀ ਔਡਰ ਘੰਟੇ ਤੱਕ ਆਉਣਾ ਜੀ ਇਹਦੇ ਵਿੱਚ ਜ਼ਿਆਦਾ ਸਮਾਂ ਹੋ ਗਿਆ ਤੁਸੀਂ ਦੱਸੋ ਵੀ ਕਿੰਨਾ ਸਮਾਂ ਲੱਗੂਗਾ ਆਉਣੇ 'ਚ ਕਾਫੀ ਅਸੀਂ ਵੇਟ ਕਰ ਰਹੇ ਆ ਤੁਹਾਡੀ ਤੁਸੀਂ ਸਾਨੂੰ ਔਡਰ ਦੱਸੋ ਵੀ ਕਦ ਤੱਕ ਆਜੂਗਾ ਅਸੀਂ ਤੁਹਾਡੇ ਬਹੁਤ ਧੰਨਵਾਦੀ ਹੋਉਂਗੇ ਜੀ ਜੇ ਤੁਸੀਂ ਔਡਰ ਕਰਤਾ ਜੀ